ਮੈਂ ਨਾ ਇੱਕ ਨਾ ਪ੍ਰੋਡਕਟ ਲੀਤਾ ਸੀਗਾ ਆਪਣੇ ਬਾਲਾਂ ਲਈ ਨਾ ਮੇਰੇ ਹੇਅਰਫੋਲ ਬਹੁਤ ਜ਼ਿਆਦਾ ਹੋ ਰਹੇ ਸੀਗੇ ਅਤੇ ਮੈਂ ਨਾ ਕਾਫੀ ਸਾਰੇ ਉਸ ਤੋਂ ਪਹਿਲਾਂ ਪ੍ਰੋਡਕਟ ਯੂਜ਼ ਕੀਤੇ ਹੈ ਅਤੇ ਬਟ ਉਹਦਾ ਨਾ ਰਿਜ਼ਲਟ ਨਾ ਬਿਲਕੁਲ ਅੱਛਾ ਨਹੀਂ ਆਇਆ ਅਤੇ ਮੇਰੇ ਹੇਅਰਫੋਲ ਈਵਨ ਮੇਰੇ ਬਹੁਤ ਜ਼ਿਆਦਾ ਹੋਣ ਲੱਗ ਗਏ ਔਰ ਈਚਿੰਗ ਡੈਂਡਰਫ ਸਾਰਾ ਕੁਛ ਹੋਣ ਲੱਗ ਗਿਆ ਜਦ ਕਿ ਪਹਿਲਾਂ ਮੇਰਾ ਕੁਛ ਨਹੀਂ ਸੀਗਾ ਅਤੇ ਫਿਰ ਨਾ ਮੈਂ ਇੱਕ ਪ੍ਰੋਡਕਟ ਯੂਜ਼ ਕੀਤਾ ਜਿਹੜਾ ਮੈਂ ਇੱਕ ਦੇਖਿਆ ਸੀਗਾ ਐਪ 'ਤੇ ਅਤੇ ਉਹ ਮੈਂ ਪ੍ਰੋਡਕਟ ਇੰਨਾਂ ਵਧੀਆ ਲੱਗਿਆ ਨਾ ਮੈਨੂੰ ਉਹ ਕਿਉਂਕਿ ਉਹਦੇ ਨਾਲ ਮੇਰੇ ਬਾਲਾਂ ਦੀ ਗਰੋਥ ਬਹੁਤ ਵਧੀਆ ਹੋ ਗਈ ਨਾਲੇ ਡੈਂਡਰਫ ਵਗੈਰਾ ਸਭ ਹੱਟ ਗਏ ਇੱਕ ਮਹੀਨਾ ਹੀ ਹਾਲੇ ਮੈਂ ਯੂਜ਼ ਕੀਤਾ ਔਰ ਹੋਰ ਕੀ ਉਹਦਾ ਨਾ ਪ੍ਰਾਈਸ ਵੀ ਬਹੁਤ ਵਧੀਆ ਸੀਗਾ ਅਤੇ ਮੈਂ ਈਵਨ ਮੈਂ ਬਹੁਤ ਜਾਣਿਆਂ ਨੂੰ ਵੀ ਐਡਵਾਈਸ ਕੀਤਾ ਕਿ ਉਹ ਬਹੁਤ ਵਧੀਆ ਪ੍ਰੋਡਕਟ ਹੈ ਕਿਉਂਕਿ ਮੇਰੇ ਤੋਂ ਇਲਾਵਾ ਮੇਰੇ ਘਰ ਦੇ ਵਿੱਚ ਵੀ ਸਾਰੇ ਯੂਜ਼ ਕਰਨ ਲੱਗ ਗਏ ਉਹ ਪ੍ਰੋਡਕਟ ਕਿਉਂਕਿ ਹੁਣ ਪਤਾ ਹੈ ਕਿ ਪਾਣੀ ਨਹੀਂ ਸਹੀ ਹੁੰਦਾ ਅਤੇ ਔਰ ਕਈ ਤਰ੍ਹਾਂ ਦੇ ਕੈਮੀਕਲਜ਼ ਅਸੀਂ ਯੂਜ਼ ਕਰਦੇ ਹਾਂ ਜਿਹੜੇ ਵੀ ਸ਼ੈਂਪੂ ਯੂਜ਼ ਕਰਦੇ ਉਹ ਨਾਲੇ ਪਹਿਲੀ ਗੱਲ ਤਾਂ ਉਹ ਕਿ ਆਯੂਰਵੈਦਿਕ ਸੀਗਾ ਔਰ ਉਹ ਰਿਜ਼ਲਟ ਇੱਦਾਂ ਵਧੀਆ ਆਇਆ ਕਿਉਂਕਿ ਉਹਦੀ ਇੱਕ ਫਰੈਗਨੈਂਸ ਬਹੁਤ ਅੱਛੀ ਸੀਗੀ ਉਹਦੇ ਵਿੱਚ ਸਾਰੇ ਜਿਹੜੇ ਨੈਚੂਰਲ ਪਲਾਂਟਸ ਪਾਏ ਹੋਏ ਸੀਗੇ ਔਰ ਬਹੁਤ ਵਧੀਆ ਉਹਦੀ ਸਮੈਲ ਸੀਗੀ ਅਤੇ ਮੈਂ ਉਹ ਹਾਲੇ ਤਾਂ ਮੈਨੂੰ ਇੱਕ ਮਹੀਨਾ ਹੀ ਹੋਇਆ ਉਹ ਪ੍ਰੋਡਕਟ ਯੂਜ਼ ਕਰਦੇ ਨੂੰ ਅਤੇ ਉਹਦੇ ਨਾਲ ਮੈਨੂੰ ਰਿਜ਼ਲਟ ਫਿਲਹਾਲ ਤਾਂ ਅੱਛਾ ਮਿਲਿਆ ਲੈਂਥ ਵੀ ਵੱਧ ਗਈ ਹੈ ਔਰ ਜਿਹੜੇ ਮੇਰੇ ਬਾਲਾਂ ਦੀ ਹਾਰਡਨੈੱਸ ਉਹ ਵੀ ਬੜੀ ਵਧੀਆ ਹੋ ਗਈ ਹੈ ਸਟੇਅ ਰਹਿ ਰਹੇ ਹੈ ਕਾਫੀ ਲੌਂਗ ਟਾਈਮ ਤੱਕ ਮੈਂ ਅਗਰ ਮੈਂ ਉਹਨੂੰ ਦੇਖਾਂ ਕਿ ਹਾਂਜੀ ਮੈਂ ਤਿੰਨ ਚਾਰ ਦਿਨ ਰੱਖਣੇ ਜਾਂ ਪੰਜ ਦਿਨ ਰੱਖਣੇ ਉਸ ਤੋਂ ਬਾਅਦ ਵੋਸ਼ ਕਰਨੇ ਤਾਂ ਵੀ ਉਹ ਨਾ ਪ੍ਰੋਡਕਟ ਰਹਿ ਰਿਹਾ ਉਸ ਤਰੀਕੇ ਨਾਲ ਔਰ ਕਾਫੀ ਸਮੂਥੀ ਹੋ ਗਏ ਲਾਈਕ ਜਿਵੇਂ ਆਪਾਂ ਸਮੂਥਨਿੰਗ ਕਰਵਾਉਂਦੇ ਆ ਨਾ ਤਾਂ ਉਹ ਜਿਹੜਾ ਪ੍ਰੋਡਕਟ ਹੈ ਮੈਨੂੰ ਬਹੁਤ ਵਧੀਆ ਲੱਗਿਆ